ਅਸੀਂ ਨੇੜੇ ਕਬਸਣ ਜਾਂ ਸ਼ਹਿਰਾਂ ਬਜ਼ਾਰਾਂ ਦੀ ਯਾਤਰਾ ਸਮੇਂ ਇਸ ਦੀ ਸੁਰੱਖਿਆ ਅਸ ਕਰਨੀ ਕਿਉਂਕੀ ਸੜਕਾਂ ਟੁੱਟੀਆਂ ਗਲੀਆਂ ਟੁੱਟੀਆਂ ਪਈਆਂ ਜਿਸ ਕਰਕੇ ਸਾਨੂੰ ਸੀਟ ਬੈਲਟ ਲਾ ਲਾਉਣੀ ਪੈਂਦੀ ਹੈ ਵਧੀਆ ਤਰੀਕੇ ਨਾਲ ਸੀਟ ਬੈਲਟ ਲਾਉਣੀ ਪੈਂਦੀ ਹੈ ਜਿਸ ਨਾਲ ਕਿ ਅਸੀਂ ਆਪ ਆਪਣੀ ਸਿਹਤ ਨੂੰ ਸੁਰੱਖਿਆ ਰੱਖਈਏ ਅਸੀਂ ਆਪ ਸੁਰੱਖਿਆ ਰੱਖੀਏ ਨਾ ਕਿਸੇ ਹੋਰ ਕਹੀਏ ਕਈ ਵਾਰ ਸੜਕਾਂ ਟੁੱਟੀਆਂ ਫੁੱਟੀਆਂ ਹੁੰਦੀਆਂ ਜਿਨ੍ਹਾਂ ਕਾਰਣ ਸਾਢੇ ਜੇ ਅਸੀਂ ਸੀਟ ਬੈਲਟ ਨਾ ਲਾਈਏ ਸਾਡੇ ਤਾਂ ਨੁਕਸਾਨ ਪੈਦਾ ਹੁੰਦੇ ਆ ਅ ਸੁਰੱਖਿਆ ਲਈ ਸਾਨੂੰ ਸੀਟ ਬੈਲਟ ਲਗਾਉਣੀ ਪੈਂਦੀ ਆ ਅਤੇ ਮੈਂ ਸ਼ੜਕਾਂ ਬਹੁਤ ਟੁੱਟੀਆਂ ਫੁੱਟੀਆਂ ਹੁੰਦੀਆਂ ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪੈਂਦਾ ਹੈ ਡੂਮ ਦੇ ਵਿੱਚ ਪਾਣੀ ਖੜਿਆ ਹੁੰਦਾ ਪਾਣੀ ਨਾਲ ਸਾਡਾ ਮਤਲਬ ਬਹੁਤ ਜ਼ਿਆਦਾ ਹੁਣ ਤੱਕ ਬਿਮਾਰੀਆਂ ਪਾਣੀ ਵਿੱਚ ਮੱਛਰ ਹੋ ਜਾਂਦਾ ਜਿਹਦੇ ਨਾ ਸਾਡੀ ਸਾਨੂੰ ਬਿਮਾਰੀ ਵੱਧਦੀ ਹੈ ਇਸ ਲਈ ਸਾਡੀ ਸੁਰੱਖਿਆ ਦੇ ਲਈ ਅਸੀਂ ਗੱਡੀਆਂ 'ਚ ਜਾਂਦੇ ਹਾਂ ਅਤੇ ਸਾਨੂੰ ਸੀਟ ਬੈਲਟ ਲਾਉਣੀਆਂ ਪੈਂਦੀਆਂ ਇਹਨਾਂ ਨਾਲ ਕਿ ਸਾਨੂੰ ਕੋਈ ਵੀ ਸਾਡੇ ਸ਼ਰੀਰ ਨੂੰ ਕੋਈ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਾ ਲੱਗੇ ਇਸ ਕਰਕੇ ਸਾਨੂੰ ਸੁਰੱਖਿਆ ਜਗ੍ਹਾਵਾਂ ਦਾ ਅਨੁਪਾਤ ਕੀਤ ਕਰਨਾ ਪੈਂਦਾ ਹੈ ਕਿ ਅਸੀਂ ਆਪਣੀ ਸਿਹਤ ਲਈ ਵਧੀਆ ਰਹੀਏ ਅਤੇ ਸਾਨੂੰ ਅਸੀਂ ਆਪ ਵੀ ਸ਼ਰੀਰ ਨੂੰ ਬਹੁਤ ਵਧੀਆ ਚੀਜ਼ ਤਰੀਕੇ ਨਾਲ ਸ ਸੰਭਾਲ ਕੇ ਸੁਰੱਖਿਆ ਕਰ ਸਕੀਏ ਕਿ ਜਿਨ੍ਹਾਂ ਨਾਲ ਸਾਡੇ ਸ਼ਰੀਰ ਦੇ ਉਹ ਨਾ ਹੋਵੇ ਨੁਕਸਾਨ ਨਾ ਪੈਦਾ ਹੋਣ ਅਤੇ ਅਸੀਂ ਕੋਈ ਕਈ ਪਿੰਡਾਂ ਵਿੱਚ ਜਾ ਕਈ ਵਾਰ ਸ਼ਹਿਰ ਜਾਣਾ ਹੁੰਦਾ ਹੈ ਤਾਂ ਅਸੀਂ ਚਾਹੁੰਦੇ ਹਾਂ ਅਤੇ ਉੱਥੇ ਕਈ ਵਾਰੀ ਪਿੰਡਾਂ ਦੇ ਵਿੱਚ ਸ਼ੜਕਾਂ ਟੁੱਟੀਆਂ ਫੁੱਟੀਆਂ ਹੁੰਦੀਆਂ ਅਤੇ ਜਿੰਨਾ ਕਾਰਣ ਸਾਨੂੰ ਸੀਟ ਬੈਲਟ ਲਾਉਣੀ ਪੈਂਦੀਆਂ ਜੇ ਅਸੀਂ ਸੀਟ ਬੈਲਟ ਨਾ ਲਾਈਏ ਤਾਂ ਕਈ ਵਾਰ ਅਗਾਂਹ ਪੁਲਸ ਖੜੀ ਹੁੰਦੀ ਅਤੇ ਉਸ ਸਾਨੂੰ ਪੁਲਿਸ ਨੂੰ ਕਰਾਇਆ ਭਰਨਾ ਪੈਂਦਾ ਹੈ ਤਾਂ ਇਸ ਲਈ ਅਸੀਂ ਸੀਟ ਬੈਲਟ ਲਾ ਕੇ ਰੱਖਦੇ ਹਾਂ ਜਿੱਥੇ ਵੀ ਕਿਥੇ ਜਾਣਾ ਕਈ ਵਾਰੀ ਸੜਕਾਂ ਟੁੱਟੀਆਂ ਫੁੱਟੀਆਂ ਕਲੀਆਂ ਟੁੱਟ ਸਾਨੂੰ